ਵੈਸੇ ਤਾਂ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਜਦੋਂ ਮੈਂ ਪਲੱਸ ਟੂ ਕੀਤੀ ਉਹ ਤੋਂ ਬਾਅਦ ਜਿਹੜਾ ਮੇਰਾ ਬਾਹਰ ਜਾਣ ਜਾ ਕੇ ਪੜ੍ਹਾਈ ਕਰਨ ਦਾ ਜਿਹੜਾ ਮੇਰਾ ਫੈਸਲਾ ਸੀਗਾ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਮਤਲਬ ਸਭ ਤੋਂ ਵੱਡੀ ਜਿਹੜੀ ਚੁਣੌਤੀ ਆਈ ਕਿ ਜਿਹੜੀ ਦੂਸਰੀ ਕੰਟਰੀ 'ਚ ਗਿਆ ਮੈਂ ਦੂਆ ਨਿਊਜ਼ੀਲੈਂਡ ਜਿਵੇਂ ਗਿਆ ਉੱਥੇ ਜਾ ਕੇ ਉਹਨਾਂ ਦੀ ਭਾਸ਼ਾ ਬੋਲਣੀ ਉਹਨਾਂ ਦੇ ਤੌਰ ਤਰੀਕੇ ਸਿੱਖਣੇ ਉੱਥੇ ਜਾ ਕੇ ਕੰਮ ਕਰਨਾ ਜਿਵੇਂ ਕਿ ਉੱਥੇ ਮੇਰਾ ਕੋਈ ਵੀ ਨਹੀਂ ਨਹੀਂ ਸੀਗਾ ਕੋਈ ਜਾਣਕਾਰ ਨਹੀਂ ਸੀਗਾ ਤਾਂ ਉੱਥੇ ਜਦ ਮੈਂ ਗਿਆ ਪੜ੍ਹਾਈ ਵਾਸਤੇ ਮੈਨੂੰ ਬਹੁਤ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ ਜਿਵ ਜਦੋਂ ਕਿ ਮੈਂ ਉੱਥੋਂ ਏਅਰਪੋਰਟ 'ਤੇ ਉਤਰਿਆ ਤਾਂ ਮੈਨੂੰ ਇੱਕ ਮੇਰਾ ਦੋਸਤ ਸੀਗਾ ਉਹ ਲੈਣ ਆਇਆ ਉਹ ਤੋਂ ਬਾਅਦ ਮੈਨੂੰ ਉਹਨੇ ਦੋ ਦਿਨ ਆਪਣੇ ਕੋਲ ਰੱਖਿਆ ਉਹ ਤੋਂ ਬਾਅਦ ਮੈਨੂੰ ਆਪਣਾ ਘਰ ਸਭ ਕੁਛ ਕਾਰਡ ਕੂਡ ਜਿਹੜੇ ਬੈਂਕ ਦੇ ਹੁੰਦੇ ਨੇ ਅਤੇ ਆਪਣਾ ਕਾਰਡ ਹੁੰਦੇ ਨੇ ਜੀ ਅਤੇ ਆਪਣੀਆਂ ਹੋਰ ਕਈ ਤਰ੍ਹਾਂ ਦੀਆਂ ਡੋਕੂਮੈਂਟੇਸ਼ਨ ਹੁੰਦੀਆਂ ਨੇ ਉਹ ਮੈਨੂੰ ਆਪ ਹੀ ਕਰਵਾਉਣੀਆਂ ਪਈਆਂ ਜਿਨ੍ਹਾਂ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਸੀਗੀ ਅਤੇ ਉਹ ਮੈਨੂੰ ਇੰਟਰਨੈੱਟ 'ਤੇ ਉਹਦੇ ਬਾਰੇ ਮੈਂ ਰਿਸਰਚ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਅਤੇ ਉੱਥੇ ਦਾ ਜਿਹੜਾ ਲਾਈਫ ਸਟਾਈਲ ਹੈਗੀ ਜੀਣ ਦਾ ਤਰੀਕਾ ਹੈ ਉਹ ਬਹੁਤ ਜ਼ਿਆਦਾ ਆਪਣੇ ਦੇਸ਼ ਨਾਲੋਂ ਵੱਖਰਾ ਹੈ ਕਿਉਂਕਿ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪੜ੍ਹਨਾ ਵੀ ਪੈਂਦਾ ਹੈ ਅਤੇ ਕੰਮ ਵੀ ਕਰਨਾ ਪੈਂਦਾ ਹੈ ਅਤੇ ਤੁਹਾਡੇ ਕੋਲ ਬਿਲਕੁਲ ਵੀ ਰੈਸਟ ਕਰਨ ਦਾ ਵਿਹਲ ਦਾ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਤੁਹਾਡਾ ਜਿਆਦਾਤਰ ਟਾਈਮ ਕੰਮ 'ਤੇ ਜਾਂ ਪੜ੍ਹਾਈ 'ਤੇ ਚਲੇ ਜਾਂਦਾ ਹੈ ਅਤੇ ਉਹਦੇ ਵਿੱਚੋਂ ਜਿਹੜਾ ਵੀ ਤੁਸੀਂ ਪੈਸਾ ਆਪਣਾ ਕਮਾਈ ਕੀਤੀ ਹੁੰਦੀ ਹੈ ਉਹ ਜਿਹੜੀ ਹੈ ਕੋਲਜ ਦੀਆਂ ਜਿਹੜੀਆਂ ਫੀਸਾਂ ਹੁੰਦੀਆਂ ਹਨ ਉਹ ਭਰਨੇ 'ਚ ਚਲੇ ਜਾਂਦੀ ਹੈ ਜਾਂ ਹੋਰ ਜਿਹੜੇ ਤੁਹਾਡੇ ਰਹਿਣ ਸਹਿਣ ਦੇ ਖਰਚੇ ਹੁੰਦੇ ਨੇ ਉਹਨਾਂ 'ਤੇ ਚਲੇ ਜਾਂਦੀ ਹੈ